ਸਰੀਰਕ ਕਸਰਤ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਇਸ ਦੇ ਬਹੁਤ ਸਾਰੇ ਫਾਇਦੇ ਹਨ ਮੈਂ ਸਮੇਂ ਸਮੇਂ ਦੌਰਾਨ ਸਵੇਰ ਦੀ ਸੈਰ ਅਤੇ ਦੌੜ ਲਗਾਉਂਦੀ ਰਹਿੰਦੀ ਹਾਂ ਪਰ ਮੈਂ ਕਿਸੇ ਵੀ ਖੇਡ ਜਾਂ ਕਿਸੇ ਵਿਸ਼ੇਸ਼ ਕੰਪੀਟੀਸ਼ਨ ਵਿੱਚ ਕਦੇ ਭਾਗ ਨਹੀਂ ਲਿਆ